ਹੈਲੋ ਸੱਸ ਸੱਸਰੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਠੀਕ ਹੈ ਸਰ ਤੁਸੀਂ ਸੁਣਾਓ ਤੁਹਾਡਾ ਕੀ ਹਾਲ ਚਾਲ ਠੀਕ ਹੋ ਉਹ ਇਸ ਤਰਾਂ ਮੈਂ ਚੰਡੀਗੜ੍ਹ ਅਤੇ ਮੈਂ ਆਉਣਾ ਪੰਜਾਬ ਘੁੰਮਣ ਵਿਦ ਫੈਮਲੀ ਅਤੇ ਦੱਸੋ ਪੰਜਾਬ 'ਚ ਕਿਹੜੇ ਕਿਹੜੇ ਕਿਹੜੇ ਕਿਹੜੇ ਹੈਗੇ ਸ਼ਹਿਰ ਜਿੱਧਰ ਆਪਾਂ ਘੁੰਮ ਸਕੀਏ

ਅਤੇ ਅੰਮ੍ਰਿਤਸਰ ਕਿਹੜੀਆਂ ਕਿਹੜੀਆਂ ਚੀਜ਼ਾਂ ਦੇਖਣ ਵਾਲੀਆਂ ਹੂੰ ਹੂੰ ਅਤੇ ਅਤੇ

ਅਤੇ ਤੁਹਾਡੀ ਰੈਜੀਡੈਂਸ ਕਿੱਥੇ ਅੰਮ੍ਰਿਤਸਰ ਅੱਛਾ ਜੀ

ਚਲੋ ਕੋਈ ਗੱਲ ਨਹੀਂ ਤੁਸੀਂ ਆਪਣੀ ਲੋਕੇਸ਼ਨ ਵੀ ਭੇਜ ਦੇਣਾ ਅਤੇ ਨਾਲੇ ਅੰਮ੍ਰਿਤਸਰ ਇੱਥੇ ਟੂਰਿਸਟ ਬਸ ਵੀ ਚਲਦੀ ਕੋਈ ਜਿਹੜੀ ਦਿਖਾਉਂਦੀ ਹਿਸਟੋਰੀਕਲ ਪਲੇਸ ਹੂੰ ਮੈਂ ਕਿਹਾ ਨਹੀਂ ਤਾਂ ਤੁਹਾਨੂੰ ਕਸ਼ਟ ਜ਼ਰੂਰ ਦੇਣਾ ਟੂਰਿਸਟ ਬਸ ਕਰ ਲਾਂਗੇ ਨਹੀਂ ਤਾਂ ਚਲੋ ਦੇਖ ਲਾਂਗੇ ਜਿਸ ਤਰ੍ਹਾਂ ਸੂਟ ਕਰੇਗਾ ਚਲੋ ਜਿਸ ਤਰ੍ਹਾਂ ਜਿਸ ਤਰ੍ਹਾਂ ਸੂਟ ਕਰੇਗਾ ਕੋਈ ਗੱਲ ਨਹੀਂ ਉਸ ਤਰ੍ਹਾਂ ਵੇਖ ਲਾਂਗੇ ਚਲੋ ਮੈਂ ਅਗਲੇ ਹਫਤੇ ਆਉਣਾ ਅਗਲੇ ਹਫਤੇ ਆਉਣਾ ਫਿਰ ਮੈਂ ਕਰਾਂਗਾ ਤੁਹਾਡੇ ਨਾਲ ਮਿਲ ਲਾਂਗਾ ਠੀਕ ਹੈ ਸਾਸੀ ਸਤਿ ਸ਼੍ਰੀ ਅਕਾਲ ਜੀ